ਮੇਰੇ ਬਚਪਨ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਗੱਲਾਂ ਯਾਦ ਹਨ ਪਰ ਜੋ ਗੱਲ ਬਹੁਤ ਹੀ ਜ਼ਿਆਦਾ ਮੈਨੂੰ ਯਾਦ ਆਉਂਦੀ ਹੈ ਉਹ ਗੱਲ ਇਵੇਂ ਹੈ ਕਿ ਮੈਂ ਬਚਪਨ ਦੇ ਵਿੱਚ ਉਹ ਪਹਿਲਾਂ ਦੇ ਟਾਈਮ ਦੇ ਵਿੱਚ ਗੁੱਡੀਆਂ ਬਣਾਉਂਦੇ ਸੀ ਕਾਗਜ਼ ਦੀਆਂ ਕਿਸ਼ਤੀਆਂ ਬਣਾਉਂਦੇ ਸੀ ਕਿ ਉਸ ਟਾਈਮ ਦੇ ਵਿੱਚ ਅਸੀਂ ਵੀ ਬਹੁਤ ਸਾਰਾ ਐਵੇਂ ਇੰਜੋਏ ਕਰਦੇ ਸੀ ਉਸ ਟਾਈਮ ਦੇ ਵਿੱਚ ਕੱਪੜੇ ਦੀਆਂ ਗੋਡੀਆਂ ਬਣਾ ਕੇ ਸੂਈ ਧਾਗੇ ਦੇ ਨਾਲ ਉਹਨਾਂ ਨੂੰ ਸਿਊ ਕੇ ਇਹ ਇਸ ਤੋਂ ਬਾਅਦ ਉਹਨਾਂ ਨਾਲ ਖੇਡਦੇ ਹੁੰਦੇ ਸੀ ਆਪਣੇ ਬਚਪਨ ਦੇ ਵਿੱਚ ਇਸ ਗੁੱਡੀਆਂ ਦੇ ਨਾਲ ਹੀ ਅਸੀਂ ਖੇਡਿਆ ਕਰਦੇ ਸੀ ਉਦੋਂ ਅੱਜ ਕੱਲ੍ਹ ਦੇ ਪਲਾਸਟਿਕ ਦੇ ਜਾਂ ਕੱਚ ਦੇ ਕੋਈ ਵੀ ਟੋਆਏ ਨਹੀਂ ਹੁੰਦੇ ਸੀ ਇਸ ਕਰਕੇ ਉਦੋਂ ਕੱਪੜੇ ਦੀਆਂ ਗੁੱਡੀਆਂ ਬਣਾ ਕੇ ਹੀ ਇਹ ਘਰਾਂ ਵਿੱਚ ਬੱਚੇ ਖੇਡਦੇ ਸੀ ਅਤੇ ਜਦੋਂ ਵੀ ਮੀਂਹ ਪੈਂਦਾ ਸੀ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਇਹ ਪਾਣੀ ਦੇ ਵਿੱਚ ਤੈਰਦੇ ਹੁੰਦੇ ਸੀ ਜੋ ਉਹਨਾਂ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਕੇ ਬਹੁਤ ਹੀ ਚੰਗਾ ਲੱਗਦਾ ਹੈ ਬਚਪਨ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਸੀ ਇਹ ਅਤੇ ਅੱਜ ਕੱਲ੍ਹ ਵਿਦਿਆਰਥੀਆਂ ਨੂੰ ਸਕੂਲਾਂ ਦੇ ਵਿੱਚ ਵੀ ਬਹੁਤ ਸਿਖਾਇਆ ਜਾਂਦਾ ਹੈ ਇਹ ਕੁਝ